ਸਾਡੇ ਇੱਥੇ ਬਹੁਤ ਸਾਰੇ ਸਕੂਲ ਕਾਲਜ ਜਾਂ ਸੰਸਥਾਵਾਂ ਹਨ ਜਿੱਥੋਂ ਕਲਾ ਪ੍ਰਦਰਸ਼ਨ ਵਿੱਚ ਮਹਾਨ ਪ੍ਰਦਰਸ਼ਕ ਜੋ ਕਿ ਐਹ ਮਹਾਨ ਕਲਾਕਾਰ ਬੱਚਿਆਂ ਨੂੰ ਸਿਖਾਉਂਦੇ ਹਨ ਕਿ ਕਲਾ ਪ੍ਰਦਰਸ਼ਨ ਦੇ ਚਿੱਤਰ ਕਿਵੇਂ ਚਿੱਤਰ ਕਲਾ ਸਿਖਾਉਂਦੇ ਹਨ ਚਿੱਤਰਨ ਦੀ ਕਲਾ ਸਿਖਾਉਂਦੇ ਹਨ ਇੱਥੇ ਸਾਡੇ ਇੱਥੇ ਪੰਜਾਬ ਵਿੱਚ ਇੱਕ ਸੈਕਟਰ ਵੀ ਖੁੱਲ੍ਹਿਆ ਹੈ ਜਿੱਥੇ ਮਹਾਨ ਕਲਾਕਾਰ ਦਰਸ਼ਕਾਂ ਨੂੰ ਸਿਖਾਉਂਦੇ ਹਨ ਕਿ ਕਲਾਕਾਰੀ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਇਸ ਤੋਂ ਬੱਚਿਆਂ ਨੂੰ ਗਿਆਨ ਵਾਧਾ ਹੁੰਦਾ ਹੈ ਅਤੇ ਹੋਰ ਵੀ ਸਕੂਲਾਂ ਵਿੱਚ ਵੀ ਅਲੱਗ ਤੋਂ ਹੀ ਇੱਕ ਟਾਈਮ ਪੀਰੀਅਡ ਲੱਗਦਾ ਹੈ ਕਲਾ ਦਾ ਜਿਹ ਤੋਂ ਬੱਚਿਆਂ ਵਿੱਚ ਹੁਨਰ ਪੈਦਾ ਹੁੰਦਾ ਹੈ ਅਤੇ ਉਹ ਅੱਗੇ ਵੱਧ ਚੜ੍ਹ ਕੇ ਕਲਾ ਵਿੱਚ ਭਾਗ ਲੈ ਸਕਦੇ ਹਨ